ਸਤਿ ਸ਼੍ਰੀ ਅਕਾਲ ਜੀ ਅੱਜਕੱਲ੍ਹ ਜਿਵੇਂ ਅਸੀਂ ਦੇਖਦੇ ਹਾਂ ਹਰ ਇੱਕ ਚੀਜ਼ ਦੀ ਹਰ ਇੱਕ ਇਨਸਾਨ ਦੀ ਹਰ ਇੱਕ ਖੇਤਰ ਦੇ ਵਿੱਚ ਇੰਟਰਨੈੱਟ ਦੀ ਟੈਕਨਾਲੋਜੀ ਇੱਕ ਐਸੀ ਟੈਕਨਾਲੋਜੀ ਹੈ ਜੋ ਕਿ ਮੰਨ ਲਉ ਅਸੀਂ ਇੱਕ ਸਥਾਨ 'ਤੇ ਬੈਠੇ ਹਾਂ ਔਰ ਅਸੀਂ ਇੱਕ ਸਥਾਨ ਤੋਂ ਦੂਸਰੇ ਸਥਾਨ 'ਤੇ ਜਾਣਾ ਹੈ ਅਸੀਂ ਉਸ ਦੇ ਉੱਤੇ ਆਪਣੇ ਵਿਚਾਰ ਬੋਲ ਕੇ ਲਿਖ ਕੇ ਹਰ ਇੱਕ ਪ੍ਰਕਾਰ ਦੀ ਅਸੀਂ ਜਾਣਕਾਰੀ ਲੈ ਸਕਦੇ ਹਾਂ ਲੇਕਿਨ ਹਰ ਇੱਕ ਬੰਦਾ ਹਿੰਦੀ ਔਰ ਇੰਗਲਿਸ਼ ਭਾਸ਼ਾ ਨਹੀਂ ਜਾਣਦਾ ਜਿਸ ਦੇ ਵਿੱਚ ਜ਼ਿਆਦਤਰ ਲੋਕ ਪੰਜਾਬੀ ਜਾਣਦੇ ਹਨ ਲੇਕਿਨ ਜਿਵੇਂ ਕਿ ਸਾਨੂੰ ਹਿੰਦੀ ਔਰ ਇੰਗਲਿਸ਼ ਦੇ ਵਿੱਚ ਜਲਦੀ ਤੋਂ ਜਲਦੀ ਜੋ ਵੀ ਅਸੀਂ ਬੋਲੀਏ ਲਿਖੀਏ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਔਰ ਬੰਦਾ ਆਸਾਨੀ ਨਾਲ ਆਪਣੀ ਕਾਰਵਾਈ ਕਰ ਸਕਦਾ ਹੈ ਇਸ ਤਰੀਕੇ ਨਾਲ ਜਿਵੇਂ ਕਿ ਪੰਜਾਬੀ ਇੱਕ ਐਸੀ ਭਾਸ਼ਾ ਹੈ ਜੋ ਕਿ ਦੁਨੀਆ ਦੇ ਅੰਦਰ ਹਰ ਇੱਕ ਕੋਨੇ ਦੇ ਵਿੱਚ ਪੰਜਾਬੀ ਬੰਦਾ ਰਹਿੰਦਾ ਹੈ ਲੇਕਿਨ ਇਸ ਦਾ ਨੈੱਟ ਦੇ ਮਾਧਿਅਮ ਰਾਹੀਂ ਸਹੀ ਜੋ ਉਚਾਰਨ ਹੈ ਉਹ ਔਰ ਲਿਖਤੀ ਰੂਪ ਦੇ ਵਿੱਚ ਇਸ ਦਾ ਸਹੀ ਅਨੁਵਾਦ ਹੋਣਾ ਚਾਹੀਦਾ ਹੈ ਜੋ ਕਿ ਸਹੀ ਲਿਟਰੈਚਰ ਵਿੱਚੋਂ ਲੈ ਕੇ ਜਿੱਥੇ ਜਿੱਥੇ ਵੀ ਨੈੱਟ ਦੇ ਦੁਆਰਾ ਹਿੰਦੀ ਔਰ ਅੰਗਰੇਜ਼ੀ ਦੇ ਲਫਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਉੱਥੇ ਪੰਜਾਬੀ ਦਾ ਵੀ ਜੋ ਅਨੁਵਾਦ ਹੈ ਉਹ ਲਿਖਿਆ ਹੋਣਾ ਚਾਹੀਦਾ ਹੈ ਔਰ ਉਹਨੂੰ ਓਰਗਨਾਈਜ਼ ਕਰਨਾ ਚਾਹੀਦਾ ਹੈ ਤਾਂ ਜੋ ਹਰ ਇੱਕ ਬੰਦਾ ਹਿੰਦੀ ਔਰ ਅੰਗਰੇਜ਼ੀ ਨਹੀਂ ਜਾਣਦਾ ਔਰ ਜ਼ਿਆਦਾ ਤੋਂ ਜ਼ਿਆਦਾ ਆਪਣੀ ਜੋ ਮਾਤਰ ਭਾਸ਼ਾ ਹੈ ਉਸ ਦੇ ਜ਼ਰੀਏ ਜੋ ਵੀ ਬੋਲ ਕੇ ਚਾਹੇ ਉਸ ਨੇ ਸਮਾਨ ਮੰਗਵਾਉਣਾ ਹੈ ਚਾਹੇ ਕੋਈ ਟਿਕਟ ਬੁੱਕ ਕਰਨੀ ਹੈ ਚਾਹੇ ਕਿਤੇ ਜਾਣਾ ਹੈ ਕੁਛ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਾਰਵਾਈ ਕਰਨੀ ਹੈ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਬੋਲਣ 'ਤੇ ਲਿਖਣ 'ਤੇ ਨੈੱਟ ਵਜੋਂ ਇੰਟਰਨੈੱਟ ਵੱਲੋਂ ਉਹਨਾਂ ਨੂੰ ਸਹੀ ਰਿਪਲਾਈ ਮਿਲ ਸਕੇ ਔਰ ਉਹਨਾਂ ਨੂੰ ਉਸ ਕੰਮ ਦੇ ਨੈੱਟ ਨੂੁੰ ਵਰਤਣ ਦੇ ਵਿੱਚ ਖੁਸ਼ੀ ਹੋਵੇ ਔਰ ਉਹਨਾਂ ਨੂੰ ਸਹੀ ਆਪਣਾ ਮੁਕਾਮ 'ਤੇ ਪਹੁੰਚਾ ਸਕੇ ਧੰਨਵਾਦ